ਹਾਂ ਹਾਂਜੀ ਭਾਅ ਜੀ ਹਾਂਜੀ ਭਾਅ ਜੀ ਮਾੜਾ ਜਿਹਾ ਨਾ ਉੱਧਰ ਕੀ ਆ ਆਪਣੀ ਡਾਈਟ ਮਾੜਾ ਤੁਹਾਨੂੰ ਸੁਧਾਰ ਕੇ ਚੱਲਣਾ ਪਊਗਾ ਕੀ ਜ਼ਿਆਦਾ ਚੀਜ਼ਾਂ ਜਿੱਦਾਂ ਭਾਰੀ ਚੀਜ਼ਾਂ ਨਹੀਂ ਖਾਣੀ ਬਾਹਰ ਦਾ ਸਮਾਨ ਬ ਸਮਾਨ ਸਮੂਨ ਨਹੀਂ ਖਾਣਾ ਅਤੇ ਜਿੰਨਾ ਹੋ ਸਕਦਾ ਘਰ ਦਾ ਖਾਣਾ ਖਾਓ ਅਤੇ ਮਾੜਾ ਜਿਹਾ ਨਾ ਸੈਰ ਸੂਰ ਕਰਨ ਦੀ ਕੋਸ਼ਿਸ਼ ਕਰੋ ਤਾਂਕਿ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਵਗੈਰਾ ਪੀਣਾ ਵਾ ਪਾਣੀ ਵਿੱਚ ਭਾਵੇਂ ਨਿੰਬੂ ਵਗੈਰਾ ਪਾ ਕੇ ਜਾਂ ਕੁਛ ਨਮਕ ਵਗੈਰਾ ਪਾ ਕੇ ਮਾੜਾ ਜਿਹਾ ਘੁੱਟ ਘੁੱਟ ਲੈ ਕੇ ਪੀਣਾ ਵਾ ਠੀਕ ਹੈ ਜੀ ਅਤੇ ਹਾਂਜੀ ਮੈਂ ਕਿਹਾ ਆ ਮਾੜਾ ਜਿਹਾ ਹਾਂਜੀ ਭਾਅ ਜੀ ਉਹ ਦਵਾਈਆਂ ਵਗੈਰਾ ਵੀ ਟ੍ਰਾਈ ਕਰ ਸਕਦੇ ਹੋ ਤੁਸੀਂ ਮੇਰੇ ਕੋਲ ਤੁਸੀਂ ਆਣ ਤੋਂ ਰਹੇ ਉੱਤੋਂ ਬਾਹਰ ਮੈਡੀਕਲ ਸ਼ੋਪਾਂ ਵਿੱਚ ਜਾ ਜਾ ਕੇ ਪੁੱਛੋ ਵਗੈਰਾ ਕਿ ਡਾਕਟਰ ਕੋਲੋਂ ਪੁੱਛ ਲਓ ਕਿ ਮਾੜਾ ਜਿਹਾ ਉਹ ਕੀ ਆ ਪੇਟ ਖ਼ਰਾਬ ਦੀ ਪ੍ਰੋਬਲਮ ਵਗੈਰਾ ਆਉਂਦੀ ਪਈ ਆ ਤਾਂ ਉਹਨੂੰ ਸੈੱਟ ਕਿੱਦਾਂ ਕਰਨਾ ਵਾ